ਹੈਲੋ ਹਾਂਜੀ ਸਰ ਮੈਂ ਪੰਜਾਬ ਗੁਰਦਾਸਪੁਰ ਤੋਂ ਮਾਲਤੀ ਗੱਲ ਕਰਦੀ ਪਈ ਹੈ ਮੈਂ ਤੁਹਾਡੇ ਨਾ ਇੱਕ ਪ੍ਰੋਡਕਟ ਮੰਗਾਇਆ ਸੀਗਾ ਮੈਂ ਤੁਹਾਡੇ ਕੋਲ ਨਾ ਉਹਦਾ ਐਕਸਪੀਰੀਸ ਸ਼ੇ ਸ਼ੇਅਰ ਕਰਨਾ ਸੀਗਾ ਉਹਦਾ ਮੈਂ ਕੁੜਤਾ ਸੈਟ ਮੰਗਾਇਆ ਸੀਗਾ ਕੁੜਤਾ ਸੈਟ ਸਹੀ ਹੈ ਬਹੁਤ ਸੋਹਣਾ ਆਇਆ ਬਹੁਤ ਵਧੀਆ ਆਇਆ ਉਹ ਮਤਲਬ ਪਾਉਣ 'ਚ ਵੀ ਵਧੀਆ ਉਹਦਾ ਕੱਪੜਾ ਵੀ ਬਹੁਤ ਅੱਛਾ ਔਰ ਉਹਨੂੰ ਮੈਂ ਪਹਿਲਾਂ ਇੱਥੋਂ ਪਰਚੇਜ਼ ਕਰਨ ਲੱਗੀ ਸੀਗੀ ਪਰਚੇਸ ਇੱਥੋਂ ਮਿਲਿਆ ਨਹੀਂ ਸੀਗਾ ਲੋਕਲ ਮਾਰਕੀਟ ਤੋਂ ਔਰ ਮੈਂ ਤੁਹਾਡੇ ਕੋਲੋਂ ਬਾਏ ਕਰਿਆ ਉਹ ਮੈਨੂੰ ਪ੍ਰੋਡਕਟ ਬਹੁਤ ਵਧੀਆ ਆਇਆ ਉਹ ਫੀਟਿੰਗ ਬਾਈਜ ਵੀ ਪ੍ਰੋਡਕਟ ਬਹੁਤ ਅੱਛਾ ਹੈ ਉਹਦਾ ਕੱਪੜਾ ਉਹਦਾ ਫੈਬਰਿਕ ਇੰਨਾ ਬਹੁਤ ਇੰਨਾ ਅੱਛਾ ਹੈ ਕਿ ਕੋਈ ਕਹਿਣ ਦਾ ਹਿਸਾਬ ਨਹੀਂ ਹੈ ਉਸ ਤੋਂ ਇਲਾਵਾ ਜਿਹੜਾ ਉਹਦਾ ਅੰਦਰ ਲਾਈਨਿੰਗ ਵਾਲਾ ਕੱਪੜਾ ਲੱਗਾ ਹੋਇਆ ਉਹ ਵੀ ਬਹੁਤ ਅੱਛਾ ਕਿ ਜਿਹੜਾ ਆਪਾਂ ਉਹ ਨੋਰਮਲੀ ਕੱਪੜੇ ਬਜ਼ਾਰ 'ਚੋਂ ਲੈਂਦੇ ਹਾਂ ਉਹਦਾ ਕੱਪੜਾ ਉੱਪਰ ਵਾਲਾ ਤਾਂ ਸਹੀ ਹੁੰਦਾ ਪਰ ਜਿਹੜਾ ਅੰਦਰ ਕੱਪੜਾ ਲੱਗਾ ਹੁੰਦਾ ਉਹ ਬਿਲਕੁਲ ਵੀ ਸਹੀ ਨਹੀਂ ਹੁੰਦਾ ਅਤੇ ਜੋ ਮੈਂ ਤੁਹਾਡੇ ਕੋਲੋਂ ਪ੍ਰੋਡਕਟ ਮੰਗਵਾਇਆ ਉਹਦਾ ਕੱਪੜਾ ਬਹੁਤ ਸਹੀ ਆ ਉਹ ਫਿਟਿੰਗ ਵਾਈਜ਼ ਵੀ ਡਰੈਸ ਇੰਨੀ ਸਹੀ ਹੈ ਕੋਈ ਹਿਸਾਬ ਨਹੀਂ ਸਾਰਿਆਂ ਨੇ ਹੀ ਉਹ ਡਰੈਸ ਬਹੁਤ ਪਸੰਦ ਕਰੀ ਹੈ ਮੈਨੂੰ ਖੁਦ ਨੂੰ ਵੀ ਉਹ ਡਰੈਸ ਬਹੁਤ ਅੱਛੀ ਲੱਗੀ ਆ ਮੈਂ ਜਦੋਂ ਵੀ ਪਾਈ ਆ ਸਾਰਿਆਂ ਨੇ ਮੈਨੂੰ ਕਿਹਾ ਕਿ ਡਰੈਸ ਸੋਹਣੀ ਲੱਗ ਰਹੀ ਸੀ ਮੈਂ ਉਹਦੇ ਲਈ ਇੱਕ ਪੋਜੀਟਿਵ ਐਕਸਪੀਰੀਅਸ ਤਾਂ ਮੈਂ ਸ਼ੋ ਸ਼ੇਅਰ ਕਰਨਾ ਚਾਹੁੰਦੀ ਹਾਂ ਕਿ ਬਹੁਤ ਹੀ ਅੱਛੀ ਡਰੈਸ ਹੈ ਮੈਨੂੰ ਬਹੁਤ ਪਸੰਦ ਆਈ ਹੈ ਸਾਰਿਆਂ ਨੇ ਬਹੁਤ ਪਸੰਦ ਕਰੀ ਹੈ ਡਰੈਸ ਦਾ ਕਲਰ ਸ਼ੇਪ ਸਾਈਜ਼ ਬਹੁਤ ਅੱਛਾ ਸਾਰਾ ਕੁਛ ਉਹਦੇ ਨਾਲ ਜਿਹੜਾ ਫੈਬਰਿਕ ਆ ਉਹ ਤਾਂ ਬਹੁਤ ਅੱਛਾ ਉਹਦੀ ਇਨਰ ਲਾਈਨਿੰਗ ਦਾ ਕੱਪੜਾ ਵੀ ਬਹੁਤ ਅੱਛਾ ਸਾਰਾ ਕੁਛ ਡਰੈਸ ਜਿਹੜੀ ਹੈ ਉਹ ਬਹੁਤ ਅੱਛੀ ਹੈ ਥੈਂਕ ਯੂ ਫੋਰ ਦੈਟ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਉਸ ਪ੍ਰੋਡਕਟ ਦੇ ਲਈ ਬਹੁਤ ਹੀ ਅੱਛੀ ਡਰੈਸ ਹੈ ਬਹੁਤ ਸੋਹਣੀ ਡਰੈਸ ਹੈ ਸ਼ੁਕਰੀਆ ਜੀ